ਹੈਲੋ ਨਮਸਕਾਰ ਸਰ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਅੱਛਾ ਅੱਛਾ

ਠੀਕ ਹੈ ਠੀਕ ਹੈ ਠੀਕ ਹੈ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਪਿੰਡ ਕਿਉਂ ਵਧੀਆ ਹੁੰਦੇ ਆ ਹੈ ਨਾ ਵੀ ਤੇ ਪਿੰਡ ਤੇ ਠੀਕ ਹੈ ਸਰ ਪਿੰਡ ਦੇਖੋ ਜੀ ਪਿੰਡ ਇੱਕ ਤਾਂ ਸਾਨੂੰ ਪਿੰਡਾਂ 'ਚ ਸ਼ੁੱਧ ਵਾਤਾਵਰਨ ਮਿਲਦਾ ਹੈ ਨਾ ਵਧੀਆ ਹੈ ਨਾ ਅਤੇ ਪਿੰਡਾਂ 'ਚ ਜਿਹੜਾ ਰਹਿਣ ਸਹਿਣ ਉਹ ਬੜਾ ਸਿੰਪਲ ਅਤੇ ਸਾਦਾ ਹੁੰਦਾ ਹੈ ਨਾ ਅਤੇ ਹਾਂ ਮਤਲਬ ਹੋਰ ਸਾਨੂੰ ਜਿਹੜੀ ਮਤਲਬ ਸਬਜ਼ੀਆਂ ਵਗੈਰਾ ਉਹ ਘਰ ਦੀਆਂ ਮਿਲ ਜਾਂਦੀਆਂ ਦੁੱਧ ਜਿਹੜਾ ਸਾਨੂੰ ਘਰ ਦਾ ਮਿਲ ਜਾਂਦਾ ਹੈ ਨਾ ਅਤੇ ਪਿੰਡ 'ਚ ਮਤਲਬ ਸ਼ਹਿਰਾਂ 'ਚੋਂ ਥੋੜ੍ਹਾ ਜਿਹਾ ਭੀੜ ਭੜੱਕਾ ਹੁੰਦਾ ਹੈ ਅਤੇ ਪਿੰਡ 'ਚ ਜਿਹੜੇ ਖੁੱਲ੍ਹੇ ਡੁੱਲੇ ਘਰ ਹੈ ਨਾ ਹੁੰਦੇ ਆ ਜਿੱਥੋਂ ਦਾ ਮਤਲਬ ਵੀ ਐਡਮੋਸਫੇਅਰ ਸਾਨੂੰ ਬਹੁਤ ਵਧੀਆ ਮਤਲਬ ਪਿੰਡਾਂ ਦੇ ਲੋਕਾਂ ਨੂੰ ਬਿਮਾਰੀਆਂ ਵੀ ਘੱਟ ਹੁੰਦੀਆਂ ਹੈ ਨਾ ਹਾਂਜੀ ਹਾਂਜੀ ਅਤੇ ਮੰਨ ਲਉ ਅਕੋਡਿੰਗ ਟੂ ਦੇਖਿਆ ਜਾਵੇ ਲਾਈਵ ਕਿ ਮੰਨ ਲਉ ਹੈ ਨਾ ਬਿਮਾਰੀਆਂ ਤੋਂ ਬਚਣ ਲਈ ਆਪਾਂ ਜੇ ਦੇਖਿਆ ਜਾਵੇ ਤਾਂ ਪਿੰਡਾਂ ਦੀ ਲਾਈਫ ਜਿਹੜੀ ਆ ਉਹ ਬਹੁਤ ਵਧੀਆ ਹੈਗੀ ਆ ਹੈ ਨਾ ਹਾਂ ਹਾਂ ਹਾਂ ਹਾਂ ਅਤੇ ਤੁਸੀਂ ਆਓ ਆਪਾਂ ਤੁਹਾਨੂੰ ਪਿੰਡ ਵਿਜਿਟ ਕਰਵਾਉਂਦੇ ਹਾਂ ਤੁਹਾਨੂੰ ਪਿੰਡ ਦੀਆਂ ਵਧੀਆ ਵਧੀਆ ਜਗ੍ਹਾ ਦੱਸਣ ਡਿਆ ਹੈ ਨਾ ਅਤੇ ਪਿੰਡਾਂ ਦੇ ਲੋਕਾਂ 'ਚ ਇੱਕ ਗੱਲ ਇਹ ਆ ਵੀ ਹੈਗੀ ਆ ਵੀ ਪਿੰਡਾਂ ਦੇ ਲੋਕਾਂ ਜਿਹੜਾ ਆ ਮਤਲਬ ਕਿ ਭਾਈਚਾਰਾ ਜਿਹੜਾ ਬੜਾ ਵਧੀਆ ਹੁੰਦਾ ਆਪਸ 'ਚ ਦੁੱਖ ਸੁੱਖ ਜਿਹੜੇ ਭਾਈਵਾਲ ਹੁੰਦੇ ਆ ਹੈ ਨਾ ਮਤਲਬ ਕਿਸੇ 'ਤੇ ਕਦੀ ਮੰਨ ਲਉ ਵੀ ਜੇ ਕਿਸੇ ਦੇ ਘਰ ਕੋਈ ਦੁੱਖ ਪੈ ਜਾਂਦਾ ਤਾਂ ਦੁੱਖ 'ਚ ਸ਼ਾਮਿਲ ਹੋ ਜਾਂਦੇ ਜੇ ਕੋਈ ਖੁਸ਼ੀ ਹੈ ਤਾਂ ਖੁਸ਼ੀ 'ਚ ਵੀ ਸ਼ਾਮਿਲ ਹੁੰਦੇ ਆ ਅਤੇ ਲੋਕਾਂ 'ਚ ਆਪਸ 'ਚ ਜਿਹੜਾ ਬਲ ਬੜਾ ਵੀ ਪ੍ਰੇਮ ਭਾਵ ਨਾਲ ਰਹਿੰਦੇ ਆ ਲੋਕ ਹਾਂਜੀ ਹਾਂਜੀ ਠੀਕ ਹੈ ਸਰ ਓਕੇ ਸਰ ਯੂ ਅਰ ਵੈਲਕਮ ਜੀ